ਪੰਜਾਬੀ ਭਾਸ਼ਾ ਬਾਰੇ ਕੁਝ ਗਲਤ ਧਾਰਨਾਵਾਂ ਹਨ ਜਿਵੇਂ ਕਿ ਕੁਝ ਲੋਕ ਕਹਿੰਦੇ ਹਨ ਕਿ ਪੰਜਾਬੀ ਭਾਸ਼ਾ ਬਹੁਤ ਰੁੱਖੀ ਹੈ ਇਹ ਬਹੁਤ ਅੱਖੜ ਹੈ ਨਹੀਂ ਇਹ ਗੱਲ ਨਹੀਂ ਹੈ ਪੰਜਾਬੀ ਭਾਸ਼ਾ ਤਾਂ ਬਹੁਤ ਮਿੱਠੀ ਭਾਸ਼ਾ ਹੈ ਇਹ ਰੋਅਬ ਵਾਲੀ ਭਾਸ਼ਾ ਵੀ ਹੈ ਇਹ ਗਲਤ ਧਾਰਨਾਵਾਂ ਨੂੰ ਸਾਨੂੰ ਠੀਕ ਕਰਨਾ ਚਾਹੀਦਾ ਹੈ ਉਹ ਭਾਸ਼ਾ ਕਿਵੇਂ ਗਲਤ ਹੋ ਸਕਦੀ ਹੈ ਜਿਸ ਵਿੱਚ ਸਾਡੇ ਗੁਰੂਆਂ ਨੇ ਬਾਣੀ ਲਿਖੀ ਹੋਵੇ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਨਾਨਕ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਵਰਗੇ ਰਾਈਟਰਾਂ ਨੇ ਲੇਖਕਾਂ ਨੇ ਕਿੰਨਾ ਵਧੀਆ ਸਾਹਿਤ ਪੇਸ਼ ਕੀਤਾ ਹੈ ਅਤੇ ਫਿਰ ਉਹ ਭਾਸ਼ਾ ਗਲਤ ਕਿਵੇਂ ਹੋਈ ਉਹ ਉਸ ਭਾਸ਼ਾ ਨੂੰ ਅਸੀਂ ਇੱਕ ਅਮੀਰ ਭਾਸ਼ਾ ਦਾ ਨਾਂ ਦੇ ਸਕਦੇ ਹਾਂ ਇਹ ਬੜੀ ਹੀ ਅਮੀਰ ਭਾਸ਼ਾ ਹੈ ਇਸ ਵਿੱਚ ਬਹੁਤ ਵਧੀਆ ਲਿਟਰੇਚਰ ਲਿਖਿਆ ਗਿਆ ਹੈ ਬਹੁਤ ਵਧੀਆ ਸਾਹਿਤ ਲਿਖਿਆ ਗਿਆ ਹੈ ਸਾਡੇ ਵੱਡੇ ਵੱਡੇ ਕਵੀ ਹੋਏ ਹਨ ਜਿਨ੍ਹਾਂ ਨੇ ਕਵਿਤਾ ਵਗੈਰਾ ਜਾਂ ਹੋਰ ਵੀ ਸਾਹਿਤ ਰਚਿਆ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਆਪਣੀ ਭਾਸ਼ਾ ਬਾਰੇ ਜੋ ਗਲਤ ਧਾਰਨਾਵਾਂ ਸੋਚੀਆਂ ਜਾ ਰਹੀਆਂ ਹਨ ਉਹਨਾਂ ਨੂੰ ਠੀਕ ਕੀਤਾ ਜਾਵੇ ਚਾਹੀਦਾ ਹੈ ਕਿ ਇਸ ਬੱਚੇ ਘਰ ਵਿੱਚ ਪੰਜਾਬੀ ਬੋਲਣ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲਾਂ ਕਰਨ ਕੁਝ ਲੋਕ ਸਮਝਦੇ ਹਨ ਹਿੰਦੀ ਜਾਂ ਪੰਜਾ ਇੰਗਲਿਸ਼ ਵਿੱਚ ਗੱਲ ਕਰਨ ਨਾਲ ਕੋਈ ਬਹੁਤ ਵਧੀਆ ਲੱਗਦਾ ਹੈ ਪਰ ਨਹੀਂ ਇਹ ਗੱਲ ਬਿਲਕੁਲ ਗਲਤ ਹੈ ਜੇ ਪੰਜਾਬੀ ਭਾਸ਼ਾ ਨੂੰ ਸੋਹਣੀ ਤਰ੍ਹਾਂ ਬੋਲਿਆ ਜਾਵੇ ਇਹ ਤਾਂ ਬਹੁਤ ਮਿੱਠੀ ਭਾਸ਼ਾ ਹੈ ਇਹ ਤਾਂ ਬੜੇ ਰੋਅਬ ਵਾਲੀ ਭਾਸ਼ਾ ਵੀ ਹੈ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦੇਈਏ ਉਹਨਾਂ ਨਾਲ ਘਰ ਵਿੱਚ ਪੰਜਾਬੀ 'ਚ ਗੱਲਾਂ ਕਰੀਏ ਬੇਸ਼ੱਕ ਸਕੂਲਾਂ ਵਿੱਚ ਉਹ ਇੰਗਲਿਸ਼ ਪੜ੍ਹਨ ਹਿੰਦੀ ਪੜ੍ਹਨ ਪਰ ਸਾਨੂੰ ਆਪਣੀ ਭਾਸ਼ਾ 'ਤੇ ਮਾਣ ਹੋਣਾ ਚਾਹੀਦਾ ਹੈ ਸਾਡੀ ਭਾਸ਼ਾ ਇੱਕ ਬਹੁਤ ਵਧੀਆ ਭਾਸ਼ਾ ਹੈ ਇਸ 'ਤੇ ਅਸੀਂ ਮਾਣ ਕਰੀਏ ਔਰ ਆਪਣੇ ਬੱਚਿਆਂ ਨੂੰ ਸੋਹਣੀ ਤਰ੍ਹਾਂ ਪੰਜਾਬੀ 'ਚ ਗੱਲ ਕਰਨ ਵਿੱਚ ਮਾਣ ਮਹਿਸੂਸ ਕਰਵਾਈਏ ਧੰਨਵਾਦ